ਭਾਰਤੀ ਫਿਲਮਾਂ ਭਾਰਤੀ ਫਿਲਮਾਂ ਬਹੁਤ ਹੀ ਮਨੋਜਰ ਮਨੋਰੰਜਕ ਹੁੰਦੀਆਂ ਹਨ ਭਾਰਤੀ ਫਿਲਮਾਂ ਅੰਗਰੇਜ਼ਾਂ ਵਾਲੀਆਂ ਫਿਲਮਾਂ ਨਾਲੋਂ ਕਿਤੇ ਵੱਧ ਹਾਸੇ ਵਾਲੀਆਂ ਕੋਮੇਡੀ ਵਾਲੀਆਂ ਹੁੰਦੀਆਂ ਨੇ ਸਾਡੇ ਕਲਾਕਾਰ ਬਹੁਤ ਹੀ ਉਮਦਾ ਐਕਟਿੰਗ ਕਰਦੇ ਹਨ ਦੇਸ਼ ਦੇ ਅਲੱਗ ਅਲੱਗ ਹਿੱਸੇ ਤੋਂ ਅਲੱਗ ਅਲੱਗ ਤਰ੍ਹਾਂ ਦੀਆਂ ਫਿਲਮਾਂ ਦੇਖੀਆਂ ਜਾਂਦੀਆਂ ਹਨ ਜਿਵੇਂ ਸਾਊਥ ਦੀ ਫਿਲਮਾਂ ਦੇ ਵਿੱਚ ਐਕਸ਼ਨ ਜ਼ਿਆਦਾ ਹੁੰਦਾ ਹੈ ਅਤੇ ਪੰਜਾਬ ਦੀਆਂ ਫਿਲਮਾਂ ਦੇ ਵਿੱਚ ਹਾਸੀਆਂ ਖੇਡੀਆਂ ਜ਼ਿਆਦਾ ਹੁੰਦੀਆਂ ਨੇ ਆਹ ਫਿਲਮਾਂ ਹੀ ਨੇ ਜੋ ਸਾਡਾ ਦਿਲ ਲਗਾਈ ਰੱਖਦੀਆਂ ਨੇ ਜਿਵੇਂ ਕਰੋਨਾ ਦੇ ਟਾਈਮ 'ਤੇ ਅਸੀਂ ਸਾਰੇ ਘਰ ਬੈਠੇ ਸਿਰਫ਼ ਫਿਲਮਾਂ ਅਤੇ ਸੀਰੀਜ਼ ਦੇ ਸਹਾਰੇ ਹੀ ਆਪਣਾ ਮਨੋਰੰਜਨ ਕਰਦੇ ਸੀ ਸੀਰੀਜ਼ ਸੀਰੀਜ਼ ਅੱਜ ਕੱਲ੍ਹ ਦੇ ਯੁੱਗ ਦਾ ਫਿਲਮਾਂ ਦਾ ਇੱਕ ਨਵਾਂ ਚਿਹਰਾ ਹੈ ਸੀਰੀਜ਼ ਵੀ ਅੱਜ ਕੱਲ੍ਹ ਬਹੁਤ ਹੀ ਉਮਦਾ ਆ ਰਹੀਆਂ ਹਨ ਸੀਰੀਜ਼ 'ਚ ਐਕਟਿੰਗ ਕਰਨ ਵਾਲੇ ਬਹੁਤ ਹੀ ਵਧੀਆ ਕਲਾਕਾਰ ਨੇ ਮੇਰਾ ਸਭ ਤੋਂ ਮਨ ਮਨਪਸੰਦ ਕਲਾਕਾਰ ਹੈ ਪੰਕਜ ਤ੍ਰਿਪਾਠੀ ਜਿਹਦਾ ਕਿ ਨਾਂ ਹੀ ਸੀਰੀਜ਼ ਦੇ ਵਿੱਚ ਅਤੇ ਫਿਲਮਾਂ ਦੇ ਵਿੱਚ ਦੋਵਾਂ ਖੇਤਰਾਂ ਦੇ ਵਿੱਚ ਹੀ ਨਾਂ ਬਹੁਤ ਹੀ ਵਧੀਆ ਹੈ ਪੰਕਜ ਤ੍ਰਿਪਾਠੀ ਦੀਆਂ ਕੁਝ ਸੀਰੀਜ਼ ਜਿਹੜਾ ਮੇਰੇ ਦਿਲ ਨੂੰ ਬਹੁਤ ਚੰਗੀਆਂ ਲੱਗਦੀਆਂ ਹਨ ਜਿਵੇਂ ਕਿ ਮਿਰਜ਼ਾਪੁਰ ਕ੍ਰਿਮੀਨਲ ਜਸਟਿਸ ਅਤੇ ਪੰਕ ਇਸ ਤਰ੍ਹਾਂ ਹੀ ਪੰਕਜ ਤ੍ਰਿਪਾਠੀ ਦੀ ਹਜੇ ਹੀ ਫਿਲਮ ਆਈ ਸੀ ਓ ਮਾਈ ਗੋਡ ਜਿਹੜੀ ਕਿ ਲੋਕਾਂ ਨੂੰ ਬਹੁਤ ਪਸੰਦ ਆਈ ਸੀ ਅਤੇ ਜਿੱਥੇ ਤੱਕ ਮੈਂ ਗੀਤਾਂ ਦੀ ਗੱਲ ਕਰਾਂ ਤਾਂ ਸਾਡੇ ਭਾਰਤੀ ਗੀਤ ਬਹੁਤ ਹੀ ਵਧੀਆ ਹਨ ਖ਼ਾਸ ਕਰਕੇ ਪੁਰਾਣੇ ਵੇਲੇ ਦੇ ਗੀਤ ਜਿਵੇਂ ਕਿ ਮਨੋਜ ਕੁਮਾਰ ਰਾਜੇਸ਼ ਖੰਨਾ ਮਧੂਬਾਲਾ ਦੇ ਟਾਈਮ ਦਾ ਸੰਗੀਤ ਤਾਂ ਬਹੁਤ ਹੀ ਵਧੀਆ ਸੀ ਉਹ ਤੁਸੀਂ ਆਪਣੀ ਸਾਰੀ ਫੈਮਿਲੀ ਨਾਲ ਬਹਿ ਕੇ ਸੁਣ ਸਕਦੇ ਸੀ ਅਤੇ ਜੇ ਮੈਂ ਗੱਲ ਕਰਾਂ ਪੰਜਾਬੀ ਮਿਊਜ਼ਿਕ ਦੀ ਪੰਜਾਬੀ ਗੀਤਾਂ ਦੀ ਉਹ ਵੀ ਦਲੇਰ ਮਹਿੰਦੀ ਜੀ ਹੰਸਰਾਜ ਹੰਸ ਜੀ ਦਾ ਟਾਈਮ ਬਹੁਤ ਵਧੀਆ ਸੀ ਅੱਜ ਵੀ ਦੇਸ਼ ਦੇ ਵਿੱਚ ਕੋਈ ਵੀ ਵਿਆਹ ਸ਼ਾਦੀ ਹੋਵੇ ਤਾਂ ਗੀਤ ਪੰਜਾਬੀ ਹੀ ਵੱਜਦੇ ਨੇ ਨੱਚਣ ਟੱਪਣ ਵਾਸਤੇ ਸੋ ਆਹ ਫਿਲਮਾਂ ਅਤੇ ਗਾਣਿਆਂ ਨੇ ਸਾਡੇ ਸਾਰੇ ਦੇਸ਼ ਨੂੰ ਇਕੱਠ ਕਰਕੇ ਰੱਖਿਆ ਹੋਇਆ ਹੈ